ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਹਾਂਜੀ ਹਾਂਜੀ ਹੁਣ ਤਾਂ ਦੇਖੋ ਜੀ ਸਰਦੀ ਹੈ ਇਹ ਮਤਲਬ ਇਸ ਸਮੇਂ ਦਿਸੰਬਰ ਦਾ ਤੁਹਾਨੂੰ ਪਤਾ ਹੀ ਹੈ ਮਹੀਨੇ ਇਸ ਮਹੀਨੇ 'ਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਐਥੇ ਹੈ ਨਾ ਜੀ ਜਿਹੜਾ ਫਰਵਰੀ ਦਾ ਮਹੀਨਾ ਉਹ ਠੀਕ ਹੁੰਦਾ ਹੈ ਨਾ ਉਸ 'ਚ ਜ਼ਿਆਦਾ ਠੰਡ ਹੁੰਦੀ ਹੈ ਅਤੇ ਨਾ ਗਰਮੀ ਉਹ ਘੁ ਉਹ ਮਹੀਨਾ ਮਤਲਬ ਅੱਛਾ ਘੁੰਮਣ ਲਈ ਪੰਜਾਬ 'ਚ ਹੈ ਨਾ ਜੀ ਦੇਖੋ ਜਿਵੇਂ ਜੂਨ ਹੈ ਜੂਨ ਦੇ ਵਿੱਚ ਬਹੁਤ ਗਰਮੀ ਹੁੰਦੀ ਹੈ ਇਸ ਕਾਰਨ ਵੀ ਤੁਹਾਨੂੰ ਪਤਾ ਹੀ ਹੈ ਘੁੰਮਣਾ ਔਖਾ ਹੋ ਜਾਂਦਾ ਹੈ ਨਾ ਜੀ ਅਤੇ ਜਿਹੜੇ ਆਪਾਂ ਹੁਣ ਜੂਨ ਜਿਹੜੀ ਅਗਸਤ ਸਤੰਬਰ ਉਹਦੇ 'ਚ ਬਾਰਿਸ਼ ਹੁੰਦੀ ਹੈ ਜਿਹਦੇ ਕਾਰਨ ਪ੍ਰੋਬਲਮਸ ਹੁੰਦੀਆਂ ਘੁੰਮਣ ਦੇ ਵਿੱਚ ਹੈ ਨਾ ਜੀ ਜੇ ਤੁਸੀਂ ਆਉਣਾ ਤਾਂ ਨਾ ਤੁਸੀਂ ਆਪਣਾ ਮਤਲਬ ਫਰਵਰੀ ਮਹੀਨੇ ਵਿੱਚ ਆ ਸਕਦੇ ਕਿਉਂਕਿ ਉਸ ਮਹੀਨੇ ਵਿੱਚ ਬਹੁਤ ਥਾਵਾਂ ਖੁੱਲ੍ਹ ਜਾਂਦੀਆਂ ਜਿਹਨੂੰ ਆਪਾਂ ਦੇਖ ਸਕਦੇ ਹਾਂ ਅਤੇ ਚੰਗੀ ਤਰ੍ਹਾਂ ਪੰਜਾਬ ਵਿੱਚ ਘੁੰਮ ਵੀ ਸਕਦੇ ਹਾਂ ਹਾਂਜੀ ਹਾਂਜੀ ਤੁਸੀਂ ਨਹੀਂ ਫਰਵਰੀ ਦੇ ਵਿੱਚ ਜੇ ਘੁੰਮਣ ਆਉਣਾ ਤਾਂ ਆਇਓ ਕਿਉਂਕਿ ਨਹੀਂ ਉਸ ਟਾਈਮ ਨਾ ਪੰਜਾਬ ਦੇ ਵਿੱਚ ਮੌਸਮ ਠੀਕ ਹੁੰਦਾ ਨਾ ਤਾਂ ਉਸ ਟਾਈਮ ਬਾਰਿਸ਼ ਹੁੰਦੀ ਹੈ ਨਾ ਠੰਡ ਹੁੰਦੀ ਹੈ ਨਾ ਜ਼ਿਆਦਾ ਗਰਮੀ ਹੁੰਦੀ ਹੈ ਉਹ ਮੌਸਮ ਬਹੁਤ ਵਧੀਆ ਹੁੰਦਾ ਜੀ ਘੁੰਮਣ ਲਈ ਵੀ ਤੁਸੀਂ ਆਉਣਾ ਤਾਂ ਤੁਸੀਂ ਉਹ ਮਹੀਨੇ 'ਚ ਜ਼ਰੂਰ ਆ ਸਕਦੇ ਹੋ ਅਤੇ ਮਤਲਬ ਕਾਫੀ ਸਾਰੀਆਂ ਥਾਵਾਂ ਵੀ ਖੁੱਲ੍ਹ ਜਾਂਦੀਆਂ ਨੇ ਘੁੰਮਣ ਲਈ ਅਤੇ ਕਾਫੀ ਸਾਰੀ ਥਾਂ ਹੁੰਦੀ ਹੈ ਹਨੇ ਪਰ ਜਗ੍ਹਾ ਜਗ੍ਹਾ ਘੁੰਮ ਸਕਦੇ ਹਾਂ ਅਲੱਗ ਅਲੱਗ ਥਾਵਾਂ 'ਤੇ ਜਿਵੇਂ ਕੋਈ ਵੀ ਥਾਵਾਂ ਜਿਵੇਂ ਗੁਰੂਦੁਆਰੇ ਹੋ ਗਏ ਮੰਦਿਰ ਹੋ ਗਏ ਨਹੀਂ ਹੋਰ ਵੀ ਕਈ ਹੁੰਦੀ ਆ ਜਿਵੇਂ ਮਹਿਲ ਵਗੈਰਾ ਉੱਥੇ ਘੁੰਮ ਸਕਦੇ ਹਾਂ ਆਪਾਂ ਹਾਂਜੀ ਹਾ ਓਕੇ ਓਕੇ